ਮੇਰਾ ਨਾਮ ਅਰਾਧਨਾ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅੱਜ ਅਸੀਂ ਆਪਣੇ ਪਸੰਦੀਦਾ ਗੀਤਾਂ ਦੇ ਬਾਰੇ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਆਪਣੇ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਸਾਨੂੰ ਇਹ ਪੁੱਛਦੇ ਹੋ ਕਿ ਤੁਹਾਡੇ ਪਸੰਦੀਦਾ ਗੀਤ ਕਿਹੜਾ ਹੈ ਤਾਂ ਅਸੀਂ ਇਹ ਦੱਸਣਾ ਬੜਾ ਹੀ ਮੁਸ਼ਕਲ 'ਚ ਪੈ ਜਾਂਦੇ ਹਾਂ ਕਿ ਸਾਡਾ ਪਸੰਦੀਦਾ ਗੀਤ ਕਿਹੜਾ ਹੈ ਸਾਡੇ ਜਿਹੜੇ ਧਾਰਮਿਕ ਗੀਤ ਹਨ ਉਹ ਸਾਰੇ ਹੀ ਬਹੁਤ ਹੀ ਸੋਹਣੇ ਹਨ ਉਹ ਇੰਨੇ ਕੁ ਸੋਹਣੇ ਹਨ ਕਿ ਉਹ ਸਾਨੂੰ ਸਿੱਧਾ ਹੀ ਭਗਵਾਨ ਨਾਲ ਜੋੜਦੇ ਹਨ ਚਲੋ ਅੱਜ ਅਸੀਂ ਆਪਣੇ ਪਸੰਦੀਦਾ ਗੀਤ ਦੇ ਬਾਰੇ ਇੱਕ ਗੱਲ ਕਰਦੇ ਹਾਂ ਜਿਹੜਾ ਹਨੂੰਮਾਨ ਜੀ ਦਾ ਇੱਕ ਭਜਨ ਹੈ ਉਹਨਾਂ ਨੇ ਜ ਜਦੋਂ ਸੀਤਾ ਮਾਤਾ ਅਸ਼ੋਕਵਾਟੀਕਾ ਵਿੱਚ ਬੈਠੀ ਹੋਈ ਸੀ ਤਾਂ ਹਨੂੰਮਾਨ ਜੀ ਨੇ ਇਹ ਗੀਤ ਗਾਇਆ ਸੀ ਕਿ ਜਦੋਂ ਉਹ ਸਾਰੇ ਹੀ ਇਸ ਵਿੱਚ ਰਮਾਇਣ ਸੁਣਾਉਂਦੇ ਹਨ ਸੀਤਾ ਮਾਤਾ ਨੂੰ ਸੀਤਾ ਮਾਤਾ ਜਦੋਂ ਇਹ ਗੀਤ ਸੁਣਦੀ ਹੈ ਤਾਂ ਉਹ ਬੜੀ ਹੀ ਖੁਸ਼ ਹੁੰਦੀ ਹੈ ਪਹਿਲੇ ਤਾਂ ਉਹ ਡਰ ਜਾਂਦੀ ਹੈ ਫਿਰ ਉਹ ਬਹੁਤ ਹੀ ਖੁਸ਼ ਹੁੰਦੀ ਹੈ ਕਿ ਇਹ ਕੋਈ ਰਾਮ ਜੀ ਦਾ ਦੂਤ ਆਇਆ ਹੈ ਜਦੋਂ ਇਹ ਗੀਤ ਗਾਉਂਦੇ ਹਨ ਕਿ ਰਾਮ ਜਦੋਂ ਸੀਤਾ ਮਾਤਾ ਨੂੰ ਹਨੂੰਮਾਨ ਜੀ ਸੁਣਾਉਂਦੇ ਹਨ ਕਿ ਸੁਣੋ ਰਾਮ ਕਹਾਣੀ ਸੁਣੋ ਰੇ ਰਾਮ ਕਹਾਣੀ ਉਹਦੇ ਵਿ ਇਸ ਗੀਤ ਵਿੱਚ ਸਾਨੂੰ ਦੱਸਿਆ ਗਿਆ ਹੈ ਸੀਤਾ ਮਾਤਾ ਨੂੰ ਕਿ ਇੱਕ ਰਾਮ ਜੀ ਸੀ ਜਿਨ੍ਹਾਂ ਨੇ ਜਿਹੜੇ ਬਨਵਾਸ ਵਿੱਚ ਆਏ ਸੀ ਉਹਨਾਂ ਦੀ ਇਹ ਇਸਤਰੀ ਸੀਤਾ ਮਾਤਾ ਸੀ ਜਿਹੜੀ ਕਿ ਰਾਵਣ ਉਹਨੂੰ ਚੁੱਕ ਕੇ ਲੈ ਗਿਆ ਸੀ ਸੀਤਾ ਮਾਤਾ ਨੂੰ ਉਸ ਗੀਤ ਰਸਤੇ ਗੀਤ ਰਾਹੀਂ ਸਾਰੇ ਹੀ ਰਮਾਇਣ ਸੁਣਾਉਂਦੇ ਹਨ ਅਤੇ ਸੀਤਾ ਮਾਤਾ ਬਹੁਤ ਹੀ ਖੁਸ਼ ਹੋ ਜਾਂਦੀ ਹੈ ਅਤੇ ਉਹ ਕਹਿੰਦੀ ਹੈ ਕਿ ਜਿਹੜਾ ਵੀ ਇਸ ਗੀਤ ਨੂੰ ਗਾ ਰਿਹਾ ਹੈ ਉਹ ਮੇਰੇ ਸਾਹਮਣੇ ਆ ਕੇ ਮੈਨੂੰ ਦਰਸ਼ਨ ਦੇਵੇ ਅਤੇ ਹਨੂੰਮਾਨ ਜੀ ਆ ਕੇ ਉਸਨੂੰ ਦਰਸ਼ਨ ਦਿੰਦੇ ਹਨ ਅਤੇ ਉਹ ਫਿਰ ਇੱਕ ਮੁੰਦਰੀ ਕਾ ਨਿਸ਼ਾਨੀ ਵੀ ਦਿੰਦੇ ਹਨ ਕਿ ਇਹ ਸਾਨੂੰ ਰਾਮ ਜੀ ਨੇ ਦਿੱਤੀ ਸੀ ਜਿਸ ਨੂੰ ਦੇਖ ਕੇ ਸੀਤਾ ਮਾਤਾ ਬਹੁਤ ਹੀ ਖੁਸ਼ ਹੋ ਜਾਂਦੀ ਹੈ ਇਹੋ ਜਿਹੇ ਗੀਤਾਂ ਨੂੰ ਸੁਣ ਕੇ ਸਾਨੂੰ ਬੜਾ ਹੀ ਚੰਗਾ ਲੱਗਦਾ ਹੈ ਅਤੇ ਇਹ ਸਾਨੂੰ ਬਹੁਤ ਹੀ ਪਿਆਰ ਭਾਵਨਾ ਨਾਲ ਸਮਝਾਉਂਦੇ ਹਨ ਕਿ ਸਾਨੂੰ ਹਰ ਇੱਕ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਪਿਆਰ ਨਾਲ ਰਹਿਣਾ ਚਾਹੀਦਾ ਹੈ ਸਾਨੂੰ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਅਤੇ ਸਾਨੂੰ ਜਿਹੜਾ ਵੀ ਤੁਸੀਂ ਹਮੇਸ਼ਾ ਗਾਉਣਾ ਅਸੀਂ ਪਸੰਦ ਕਰਦੇ ਹਾਂ ਉਹ ਸਾਨੂੰ ਇਹੋ ਗੀਤ ਬਹੁਤ ਹੀ ਚੰਗਾ ਲੱਗਦਾ ਹੈ ਅਸੀਂ ਇਹਨੂੰ ਹਰ ਵੇਲੇ ਗਾਉਂਦੇ ਰਹਿੰਦੇ ਹਾਂ ਇਹ ਸਾਡੀ ਜੀਵਾ 'ਤੇ ਹੀ ਬੈਠਾ ਰਹਿੰਦਾ ਹੈ ਜਿਸ ਵੇਲੇ ਵੀ ਦੇਖੋ ਸਾਨੂੰ ਇਸ ਗੀਤ ਦੀ ਕੋਈ ਨਾ ਕੋਈ ਲਾਈਨ ਸਾਡੇ ਮੂੰਹ 'ਚ ਘੁੰਮਦੀ ਰਹਿੰਦੀ ਹੈ